ਪਟਿਆਲਾ ਜਿਲ੍ਹੇ ਵਿੱਚ ਮੁੱਖ ਖੇਤੀਬਾੜੀ ਉਤਪਾਦ ਹਨ ਕਣਕ ਹੋ ਗਿਆ ਜੀਰੀ ਅਤੇ ਆਲੂਆਂ ਦੀ ਖੇਤੀ ਆ ਜਿਹੜੀ ਉਹ ਵਧੇਰੇ ਕੀਤੀ ਜਾਂਦੀ ਹੈ ਉਸ ਤੋਂ ਇਲਾਵਾ ਕ ਲੋਕ ਨੇ ਜਿਹੜੇ ਉਹ ਪਸ਼ੂ ਪਾਲਣ ਦਾ ਕੰਮ ਵੀ ਕਰਦੇ ਹਨ ਅਤੇ ਫਸਲਾਂ ਦੀ ਸਿੰਚਾਈ ਦੀ ਜੇ ਗੱਲ ਕਰੀਏ ਜ਼ਿਆਦਾਤਰ ਇੱਥੇ ਹੈ ਟਿਊਬਵੈੱਲਾਂ ਤੋਂ ਹੀ ਆ ਜਿਹੜੀ ਉਹ ਸਿੰਚਾਈ ਕੀਤੀ ਜਾਂਦੀ ਹੈ ਅਤੇ ਅੱਜ ਕੱਲ੍ਹ ਪਟਿਆਲੇ ਜਿਲ੍ਹੇ ਦੇ ਵਿੱਚ ਕਿਸਾਨ ਨੇ ਜਿਹੜੇ ਉਹ ਕਾਫ਼ੀ ਜ਼ਿਆਦਾ ਟੈਕਨੋਲੋਜੀ ਦਾ ਵੀ ਯੂਜ ਕਰ ਰਹੇ ਹਨ ਜੋ ਨਵੇਂ ਨਵੇਂ ਢੰਗ ਆ ਚੁੱਕੇ ਹਨ ਜੀਰੀ ਬੀਜਣ ਦੇ ਜਿਵੇਂ ਆਪਾਂ ਪਹਿਲਾਂ ਵਧੇਰੇ ਪਾਣੀ ਲਾ ਕੇ ਜੀਰੀ ਬੀਜਦੇ ਹੁੰਦੇ ਸੀਗੇ ਅੱਜ ਕੱਲ੍ਹ ਸੁੱਕੀ ਹੀ ਹੈ ਜਿਹੜੀ ਇਹ ਜੀਰੀ ਦੀ ਉਹ ਬਿਜਾਈ ਕੀਤੀ ਜਾਂਦੀ ਹੈ